ਭਾਰਤ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਦਿਵਾਲੀ ਹੈ ਇਹ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆਂ ਜਾਂਦਾ ਜਾਂਦਾ ਹੈ ਹਿੰਦੂ ਇਸ ਤਿਉਹਾਰ ਨੂੰ ਇਸ ਕਰਕੇ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਿਸ ਆਏ ਸੀ ਇਸ ਦਿਨ ਉਹਨਾਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਅਤੇ ਸਿੱਖ ਇਸਨੂੰ ਇਸ ਕਰਕੇ ਮਨਾਉਂਦੇ ਹਨ ਕਿਉੱਕਿ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਨੂੰ ਅਜ਼ਾਦ ਕਰਵਾਕੇ ਆਏ ਸਨ ਅਤੇ ਸਿੱਖ ਇਸ ਤਿਉਹਾਰ ਨੂੰ ਸਿੱਖ ਇਸ ਦਿਨ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਕਰਦੇ ਹਨ ਅਤੇ ਇਸ ਦੀਪ ਮਾਲਾ ਕਰਦੇ ਹਨ ਅਤੇ ਬਾਕੀ ਇਸ ਛੁੱਟ ਇਸ ਤਿਉਹਾਰ ਦੀਆਂ ਸਾਨੂੰ ਚਾਰ ਛੁੱਟੀਆਂ ਮਿਲਦੀਆਂ ਹਨ ਲੋਕ ਆਪਣੇ ਘਰਾਂ ਦੀ ਪੁਰਾਣੀਆਂ ਚੀਜਾਂ ਵੇਚ ਕੇ ਨਵੀਆਂ ਚੀਜਾਂ ਲੈ ਕੇ ਆਉਂਦੇ ਹਨ ਅਤੇ ਆਪਣੇ ਘਰਾਂ ਦੀ ਸਾਫ ਸਫ਼ਾਈ ਕਰਦੇ ਹਨ ਰਾਤ ਨੂੰ ਬੜੇ ਅਤੇ ਬੱਚੇ ਪਟਾਕੇ ਅਤੇ ਆਤਿਸ਼ਬਾਦੀ ਆਤਿਸ਼ਬਾਜੀ ਚਲਾਕੇ ਇਸ ਤਿਉਹਾਰ ਦਾ ਅਨੰਦ ਮਾਣਦੇ ਹਨ